ਸਾਈਕਲ ਚਲਾਉਣ ਸਮੇਂ ਜੋ ਧਿਆਨ ਰੱਖਣ ਵਾਲੀਆਂ ਗੱਲਾਂ ਵੈਸੇ ਤਾਂ ਸਾਈਕਲ ਸਿਹਤ ਨੂੰ ਚਲਾਉਣ ਲਈ ਬਹੁਤ ਹੀ ਇੱਕ ਵਧੀਆ ਸਾਧਨ ਹੈ ਜਿਸ ਦੇ ਨਾਲ ਕਿ ਇੱਕ ਆਪਣੀ ਸਿਹਤ ਇੱਕ ਤਾਂ ਬੈਨੀਫਿਟ ਇਹ ਹੈ ਕਿ ਸਿਹਤ ਹੈਲਥ ਸਾਡੀ ਫਿੱਟ ਰਹਿੰਦੀ ਹੈ ਰੋਜ਼ਾਨਾ ਹਰ ਇਨਸਾਨ ਨੂੰ ਦਸ ਜਾਂ ਪੰਦਰਾਂ ਕਿਲੋਮੀਟਰ ਸਾਈਕਲ ਚਲਾਉਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ ਸੁਰੱਖਿਆ ਦੀ ਅਗਰ ਗੱਲ ਕਰੀਏ ਤਾਂ ਵੈਸੇ ਸੁਰੱਖਿਆ ਦੀ ਐਡੀ ਕੋਈ ਖ਼ਾਸ ਮਸਲਾ ਨਹੀਂ ਐ ਸਾਈਕਲ ਦੇ ਦੌਰਾਨ ਮੰਨ ਲਓ ਆਪਾਂ ਜਾਂਦੇ ਹਾਂ ਤਾਂ ਇਹਦਾ ਬੈਲੈਂਸ ਇੱਕ ਤਾਂ ਸਾਈਕਲ ਦਾ ਬਹੁਤ ਆਪਣੇ ਦੋਹਾਂ ਹੱਥਾਂ ਦੇ ਵਿੱਚ ਬੈਲੈਂਸ ਹੈ ਔਰ ਪੈਰਾਂ ਦੇ ਨਾਲ ਅਸੀਂ ਪੈਡਲ ਮਾਰ ਕੇ ਅੱਗੇ ਜਾਣਾ ਹੁੰਦਾ ਹੈ ਰੇਸ ਵਧਾਉਣੀ ਉਹ ਵੀ ਆਪਣੀ ਸ ਆਪਣਾ ਹੀ ਬਲ ਲੱਗਣਾ ਘਟਾਉਣੀ ਉਹ ਵੀ ਆਪਣਾ ਹੀ ਬਲ ਲੱਗਣਾ ਹੈ ਪਰ ਜਦੋਂ ਨਾਲ ਆਪਣੇ ਕੋਈ ਸਾਈਕਲ 'ਤੇ ਕੋਈ ਸਵਾਰੀ ਬੈਠੀ ਜਾਂਦੀ ਉਹ ਸਾਡੀ ਜਿੰਮੇਵਾਰੀ ਬਣ ਜਾਂਦੀ ਹੈ ਆਪਾਂ ਇਹਨੂੰ ਮੰਜ਼ਿਲ 'ਤੇ ਪਹੁੰਚਾਣ ਪਹੁੰਚਾਣਾ ਹੈ ਅਤੇ ਬਾਕੀ ਸਾਈਕਲ ਚਲਾਉਣਾ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ ਯਾਤਰਾ ਦੌਰਾਨ ਜਿਹੜੇ ਦਸਤਾਵੇਜ਼ਾਂ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਸਾਨੂੰ ਆਪਣੇ ਨਾਲ ਡਰਾਈਵਿੰਗ ਲਾਇਸੈਂਸ ਆਧਾਰ ਕਾਰਡ ਹੋਰ ਵੀ ਜੋ ਲੋੜੀਂਦਾ ਸਾਨੂੰ ਦਸਤਾਵੇਜ਼ ਆ ਉਹ ਰੱਖਣੇ ਜ਼ਰੂਰੀ ਹੁੰਦੇ ਆ ਜਿਵੇਂ ਕਿ ਇਹਨਾਂ ਦੇ ਪੋਲਿਊਸ਼ਨ ਦੀ ਹੁੰਦੀ ਹੈ ਇੱਕ ਚਿੱਟ ਹੋਰ ਡਰਾਈਵਿੰਗ ਲਾਇਸੈਂਸ ਤਾਂ ਲਾਜ਼ਮੀ ਹੈਗਾ ਹੀ ਹੈ ਉਸਦੇ ਨਾਲ ਨਾਲ ਜੋ ਵੀ ਅੱਜ ਦੇ ਸਮੇਂ ਦੀ ਜੋ ਵੀ ਰਿਕੁਆਇਰਮੈਂਟ ਹੈ ਜੋ ਵੀ ਦਸਤਾਵੇਜ਼ ਦੀ ਡਿਮਾਂਡ ਹੁੰਦੀ ਹੈ ਉਹ ਸਾਨੂੰ ਸਾ ਨਾਲ ਰੱਖਣੇ ਚਾਹੀਦੇ ਹੈ ਔਰ ਯਾਤਰਾ ਦੌਰਾਨ ਬਾਈਕ ਜਾਂ ਹੋਰ ਕੋਈ ਵੀ ਆ ਉਹਨੂੰ ਆਪਣੇ ਨਿਯਮਾਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਟ੍ਰੈਫਿਕ ਲਾਈਟ ਵਗੈਰਾ ਉਹ ਸਾਨੂੰ ਦੇਖ ਕੇ ਹੀ ਕਰੋਸ ਕਰਨੇ ਚਾਹੀਦੀ ਹੈ ਅਗਰ ਆਪਾਂ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹਾਂ ਤਾਂ ਅੱਜ ਕੱਲ੍ਹ ਤਾਂ ਔਨਲਾਈਨ ਚਲਾਨ ਕੱਟਣ ਦਾ ਵੀ ਪ੍ਰੋਸੈਸ ਸ਼ੁਰੂ ਹੋ ਗਿਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਤਾਂ ਔਨਲਾਈਨ ਹੀ ਚਲਾਨ ਕੱਟ ਕੇ ਬੰਦੇ ਦੇ ਘਰ ਪੁੱਜ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਜੋ ਵੀ ਦਸਤਾਵੇਜ਼ ਲੋੜੀਂਦੇ ਹੈ ਹਰ ਇਨਸਾਨ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ ਜੀ